ਮੈਂ ਪਹਿਲੀ ਵਾਰੀ ਸਕੂਲ ਵਿੱਚ ਝੰਡਾ ਬਣਾਉਣਾ ਸਿੱਖਿਆ ਜਿਹਦੇ ਵਿੱਚ ਤਿੰਨ ਰੰਗ ਹੁੰਦੇ ਹਨ ਸੰਤਰੀ ਚਿੱਟਾ ਅਤੇ ਹਰਾ ਅਤੇ ਉਸ ਵਿੱਚ ਨੀਲੇ ਰੰਗ ਦਾ ਚੱਕਰ ਹੁੰਦਾ ਹੈ ਜਿਹਦੇ ਵਿੱਚ ਚੋਵੀ ਡੰਡੀਆਂ ਹੁੰਦੀਆਂ ਹਨ ਤੇ ਉਹ ਪਹਿਲੀ ਵਾਰੀ ਮੈਨੂੰ ਮੇਰੀ ਮੈਮ ਨੇ ਸਿਖਾਇਆ ਸੀ ਜਦੋਂ ਮੈਂ ਪਹਿਲੀ ਜਮਾਤ ਵਿੱਚ ਹੁੰਦੀ ਸੀ ਉਹ ਸਿੱਖ ਕੇ ਮੈਨੂੰ ਬੜਾ ਵਧੀਆ ਲੱਗਿਆ